ਜਿਵੇਂ ਕਿ ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ ਹਨ ਜਿੱਥੇ ਇਹ ਬਿਮਾਰੀਆਂ ਲੋਕਾਂ ਨੂੰ ਘੇਰ ਰਹੀਆਂ ਹਨ ਉੱਥੇ ਹੀ ਸਰਕਾਰਾਂ ਵੱਲੋਂ ਇਹਨਾਂ ਦੇ ਇਲਾਜ ਲਈ ਦਵਾਈਆਂ ਬਣਾਈਆਂ ਜਾ ਰਹੀਆਂ ਹਨ ਅੱਜ ਕੱਲ੍ਹ ਲੋਕਾਂ ਨੂੰ ਹਾਰਟ ਅਟੈਕ ਬਹੁਤ ਹੋ ਰਹੇ ਹਨ ਲੋਕਾਂ ਨੂੰ ਦਿਲ ਦੀਆਂ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ ਇਸਦਾ ਕਾਰਨ ਹੈ ਕਿ ਲੋਕਾਂ ਦਾ ਗਲਤ ਖਾਣਾ ਪੀਣਾ ਇੰਜਾਇਟੀ ਅਤੇ ਜ਼ਿਆਦਾ ਓਇਲੀ ਫੂਡ ਖਾਣ ਕਰਕੇ ਇਹ ਬਿਮਾਰੀਆਂ ਲੋਕਾਂ ਨੂੰ ਘੇਰ ਰਹੀਆਂ ਹਨ ਜੇਕਰ ਇਸ ਬਿਮਾਰੀ ਨੂੰ ਟਾਈਮ ਨਾਲ ਫੜ ਲਿਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ ਅੱਜ ਕੱਲ੍ਹ ਦਿਲ ਦੀ ਬਿਮਾਰੀ ਦੀਆਂ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ ਕਿਸੇ ਵੀ ਪੇਸ਼ੈਂਟ ਦੀ ਹਾਰਟ ਦੀ ਬਲੋਕੇਜ ਦੀ ਜਦੋਂ ਸਮੱਸਿਆ ਹੁੰਦੀ ਹੈ ਤਾਂ ਡੋਕਟਰ ਦੁਆਰਾ ਉਸਨੂੰ ਸਟੰਟ ਪਾ ਦਿੱਤਾ ਜਾਂਦਾ ਹੈ ਤਾਂ ਜੋ ਉਸਦਾ ਹਾਰਟ ਸਹੀ ਤਰੀਕੇ ਨਾਲ ਕੰਮ ਕਰ ਸਕੇ ਦਵਾਈਆਂ ਨਾਲ ਵੀ ਉਸ ਦੀਆਂ ਬਲੋਕਜ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਈਪਾਸ ਸਰਜਰੀ ਵੀ ਕੀਤੀ ਜਾਂਦੀ ਹੈ ਜੇਕਰ ਬਿਮਾਰੀ ਨੂੰ ਟਾਈਮ ਨਾਲ ਫੜ ਲਿਆ ਜਾਵੇ ਅਤੇ ਡੋਕਟਰ ਦੁਆਰਾ ਸਹੀ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਜਾਨ ਨੂੰ ਬਚਾਇਆ ਜਾ ਸਕਦਾ ਹੈ ਇਸ ਤਰ੍ਹਾਂ ਕੈਂਸਰ ਵਰਗੀ ਭਿਆਨਕ ਬਿਮਾਰੀ ਵੀ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ ਅਗਰ ਕੈਂਸਰ ਨੂੰ ਪਹਿਲੀ ਹੀ ਸਟੇਜ 'ਤੇ ਫੜ ਲਿਆ ਜਾਵੇ ਤਾਂ ਹੀ ਮੈਡੀਸਨ ਦੁਆਰਾ ਕੀਮੋਥੈਰੇਪੀ ਦੁਆਰਾ ਜਾਂ ਓਪਰੇਸ਼ਨ ਦੁਆਰਾ ਇਹਦਾ ਇਲਾਜ ਹੋ ਜਾਂਦਾ ਹੋ ਸਕਦਾ ਹੈ ਅਗਰ ਜ਼ਿਆਦਾ ਦੇਰ ਹੋ ਜਾਵੇ ਤਾਂ ਬਚਾਉਣਾ ਬਹੁਤ ਮੁਸ਼ਕਲ ਹੈ ਕੀਮੋਥੈਰੇਪੀ ਦੁਆਰਾ ਕੈਂਸਰ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਸਰਕਾਰ ਦੁਆਰਾ ਇਹਨਾਂ ਭਿਮਾਰਕ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਹਰ ਸੰਭਵ ਟ੍ਰੀਟਮੈਂਟ ਅਤੇ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਧੰਨਵਾਦ